ਮੈਂ ਖਾਣਾ ਚੁੱਲ੍ਹੇ ਦੀ ਚੁੱਲ੍ਹੇ 'ਤੇ ਪਕਾਇਆ ਹੈ ਕਿਉਂਕਿ ਚੁੱਲ੍ਹੇ ਦੀ ਰੋਟੀ ਸਾਡੇ ਲਈ ਬਹੁਤ ਚੰਗੀ ਹੈ ਗੈਂਸ ਦੀ ਰੋਟੀ ਸਾਡੇ ਲਈ ਹਾਨੀਕਾਰਕ ਹੈ ਇਸ ਤੋਂ ਸਾਨੂੰ ਬਹੁਤ ਬਿਮਾਰੀਆਂ ਲੱਗਦੀਆਂ ਹਨ ਚੁੱਲ੍ਹੇ ਦੀ ਰੋਟੀ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ ਚੁੱਲ੍ਹੇ ਦੀ ਰੋਟੀ ਦਾ ਇਹ ਫਾਇਦਾ ਹੈ ਇਸ ਤੋਂ ਸਾਨੂੰ ਬਹੁਤ ਵਧੀਆ ਹੈ ਕਿਉਂਕਿ ਚੁੱਲ੍ਹੇ ਵਾਸਤੇ ਸਾਨੂੰ ਬਾਲਣ ਆਪਣੇ ਘਰੋਂ ਹੀ ਮਿਲ ਜਾਂਦਾ ਹੈ ਅਤੇ ਗੈਂਸ ਲਈ ਸਾਨੂੰ ਬਾਹਰ ਜਾਣਾ ਪੈਂਦਾ ਹੈ ਗੈਂਸ ਦੀ ਰੋਟੀ ਸਾਡੇ ਲਈ ਬਹੁਤ ਹਾਨੀਕਾਰਕ ਹੈ ਚੁੱਲ੍ਹੇ 'ਤੇ ਰੋਟੀ ਪਕਾਉਣ ਸਮੇਂ ਬਹੁਤ ਹੀ ਚੰਗਾ ਲੱਗਦਾ ਹੈ ਗੈਂਸ ਦੀ ਰੋਟੀ ਸਾਡੇ ਲਈ ਹਾਨੀਕਾਰਕ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਉਹ ਖਾਣ ਵਿੱਚ ਵੀ ਘੱਟ ਸਵਾਦ ਹੁੰਦੀ ਹੈ ਚੁੱਲ੍ਹੇ ਦੀ ਰੋਟੀ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ ਚੁੱਲ੍ਹੇ 'ਤੇ ਜੋ ਕੁਝ ਅਸੀਂ ਬਣਾਉਂਦੇ ਹਾਂ ਉਹ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਗੈਂਸ 'ਤੇ ਜੋ ਚੀਜ਼ ਬਣਾਉਂਦੇ ਹਾਂ ਉਹ ਵਧੀਆ ਘੱਟ ਸਵਾਦ ਬਣਦੀ ਹੈ ਚੁੱਲ੍ਹੇ 'ਤੇ ਵਧੀਆ ਬਣਦੀ ਹੈ ਥੈਂਕ ਯੂ